ਜਿਹੜੀ ਫੁਲਕਾਰੀ ਹੈ ਇਹ ਸਾਡੀ ਇੱਕ ਬਹੁਤ ਪੁਰਾਣੀ ਸੱਭਿਆਚਾਰ ਦੇ ਤੌਰ 'ਤੇ ਇਹ ਵੀ ਇੱਕ ਫੁਲਕਾਰੀ ਜੋ ਸਾਡੀ ਪੁਰਾਣੇ ਟਾਈਮ ਤੋਂ ਚਲਦੀ ਆ ਰਹੀ ਹੈਗੀ ਅਤੇ ਜਿਹੜੀ ਫੁਲਕਾਰੀ ਹੈਗੀ ਉਹ ਹੱਥੀਂ ਕਿਰਤ ਕਰਕੇ ਕੱਢੀ ਜਾਂਦੀ ਹੈਗੀ ਉਹਦੇ ਵਿੱਚ ਬਹੁਤ ਕਲਰ ਦੀ ਰੰਗ ਪਾਏ ਜਾਂਦੇ ਹੈਗੇ ਉਹ ਰੇਸ਼ਮੀ ਧਾਗੇ ਨਾਲ ਕੱਢੀ ਜਾਂਦੀ ਹੈਗੀ ਜਿਹੜਾ ਉਹਦਾ ਕੱਪੜਾ ਹੁੰਦਾ ਉਹ ਸੂਤੀ ਹੁੰਦਾ ਗਾ ਪਹਿਲਾਂ ਉਹਨੂੰ ਤਿਆਰ ਕੀਤਾ ਜਾਂਦਾ ਹੱਥੀਂ ਬਾਅਦ 'ਚ ਉਹਨੂੰ ਕਲਰ ਕੀਤਾ ਜਾਂਦਾ ਆਪਦੀ ਆਪਦੀ ਪਸੰਦ ਦਾ ਫਿਰ ਅੱਗੇ ਉਹਦੇ 'ਚ ਕਲਰ ਪਾਏ ਜਾਂਦੇ ਆ ਅਤੇ ਇਹ 'ਤੇ ਬਹੁਤ ਹੀ ਮਿਹਨਤ ਲੱਗਦੀ ਹੈ ਇਹਨੂੰ ਹੱਥੀਂ ਕੱਢਿਆ ਜਾਂਦਾ ਗਾ ਅਤੇ ਇਹ ਸਾਡੇ ਸੱਭਿਆਚਾਰ ਦੀ ਇੱਕ ਪਹਿਚਾਣ ਹੈਗੀ ਅਤੇ ਜਿਹਨੂੰ ਬਹੁਤ ਲੋਕ ਪਸੰਦ ਕਰਦੇ ਆ ਅਤੇ ਇਹਦਾ ਦੌਰ ਅੱਜ ਦੇ ਯੁੱਗ 'ਚ ਵੀ ਬਹੁਤ ਜ਼ਿਆਦਾ ਚੱਲ ਰਿਹਾ ਲੋਕ ਬਹੁਤ ਜ਼ਿਆਦਾ ਪੈਸੇ ਖਰਚ ਕਰਕੇ ਸੱਭਿਆਚਾਰ ਨੂੰ ਖਰੀਦਦੇ ਹੈਗੇ ਵੀ ਆਪਣੇ ਸੱਭਿਆਚਾਰ ਨਾਲ ਇੱਕ ਰਿਲੇਟਿਡ ਹੈਗਾ ਅਤੇ ਹਾਂ ਸਾਡੇ ਕੋਲ ਇੱਕ ਫੁਲਕਾਰੀ ਹੈ ਜਿਸ ਜੋ ਮੇਰੀ ਨਾਨੀ ਜੀ ਦੇ ਹੱਥੀਂ ਕਿਰਤ ਕੀਤੀ ਹੋਈ ਹੈਗੀ ਅਤੇ ਉਹਨਾਂ ਨੂੰ ਬਹੁਤ ਪਸੰਦ ਸੀ ਉਹਨਾਂ ਨੇ ਅੱਗੋਂ ਮੇਰੀ ਮੰਮੀ ਦਿੱਤੀ ਮੰਮੀ ਲੈ ਕੇ ਜਾਂਦੇ ਹਰ ਫੰਕਸ਼ਨ ਦੇ ਵਿੱਚ ਮੈਨੂੰ ਵੀ ਉਹ ਚੀਜ਼ ਬਹੁਤ ਵਧੀਆ ਲੱਗਦੀ ਸੀ ਅੱਗੋਂ ਉਹਨਾਂ ਨੇ ਮੇਰੇ ਵਿਆਹ ਵੇਲੇ ਮੈਨੂੰ ਦਿੱਤੀ ਆ ਅਤੇ ਉਹ ਮੈਨੂੰ ਆਪਦੀ ਜਾਨ ਤੋਂ ਵੀ ਪਿਆਰੀ ਆ ਉਹ ਮੇਰੀ ਮੇਰੇ ਪੁਰਖਿਆਂ ਦੀ ਪਸੰਦ ਹੈਗੀ ਜੋ ਉਸ ਫੁਲਕਾਰੀ ਨਾਲ ਮੇਰੀਆਂ ਯਾਦਾਂ ਜੁੜੀਆਂ ਹੋਈਆਂ ਮੇਰੀ ਨਾਨੀ ਜੀ ਦੀਆਂ ਮੇਰੀ ਮੰਮੀ ਜੀ ਦੀਆਂ ਅਤੇ ਮੇਰੀ ਇੱਛਾ ਕਿ ਅੱਗੋਂ ਮੈਂ ਵੀ ਇਹ ਆਪਦੇ ਬੱਚਿਆਂ ਨੂੰ ਦੇ ਕੇ ਜਾਵਾਂ ਤਾਂ ਕਿ ਉਹ ਵੀ ਇਹਨਾਂ ਯਾਦਾਂ ਨੂੰ ਅੱਗੇ ਸਾਂਭ ਰੱਖਣ ਅਤੇ ਮੈਂ ਵੀ ਉਹ ਆਪਦੇ ਪੁਰਖਿਆਂ ਦੀਆਂ ਯਾਦਾਂ ਨੂੰ ਉਸ ਫੁਲਕਾਰੀ ਦੇ ਜਰੀਏ ਸਾਂਭ ਕੇ ਰੱਖਿਆ ਹੋਇਆ ਗਾ ਅਤੇ ਮੇਰੀ ਇਹੀ ਇੱਛਾ ਹੈ ਕਿ ਇਹ ਇੱਕ ਸਾਡਾ ਸੱਭਿਆਚਾਰ ਵੀ ਹੈ ਜੋ ਸਾਂਭਿਆ ਹੋਇਆ ਅਤੇ ਸਾਡੇ ਪੁਰਖਿਆਂ ਦੀਆਂ ਯਾਦਾਂ ਵੀ ਹੈ ਜੋ ਅਸੀਂ ਸਾਂਭੀਆਂ ਹੋਈਆਂ ਅਤੇ ਅੱਗੋਂ ਵੀ ਇਹਨਾਂ ਨੂੰ ਸਾਂਭਿਆ ਜਾਵੇ ਮੇਰੇ ਬੱਚਿਆਂ ਰਾਹੀਂ ਮੇਰੀ ਇਹੀ ਉਮੀਦ ਹੈ